ਮੇਰੀ ਰੋਜ਼ ਦੀ ਖਾਣੇ ਦੀ ਖ਼ੁਰਾਕ ਵਿੱਚ ਮੈਂ ਆਪਣੀ ਇੱਕ ਚੀਜ਼ ਦਾ ਧਿਆਨ ਰੱਖਦਾ ਹਾਂ ਕਿ ਜਿੰਨੇ ਵੀ ਖਣਿਜ ਪਦਾਰਥ ਜਿਵੇਂ ਕਿ ਵਿਟਾਮਿਨਸ ਮਿਨਰਲ ਫਾਈਬਰ ਕਾਰਬੋਹਾਈਡ ਅਤੇ ਪ੍ਰੋਟੀਨ ਉਹਦੇ ਵਿੱਚ ਉਪਲੱਬਧ ਹੋਣ ਅਤੇ ਇੱਕ ਸੰਤੁਲਿਤ ਖ਼ੁਰਾਕ ਸਿਹਤ 'ਤੇ ਬਹੁਤ ਹੀ ਜ਼ਿਆਦਾ ਪ੍ਰਭਾਵ ਪਾਉਂਦੀ ਹੈ ਜੇਕਰ ਆਪਣੀ ਅ ਖ਼ੁਰਾਕ ਵਿੱਚ ਜਿੰਨੇ ਹੀ ਖਣਿਜ ਪਦਾਰਥ ਮੌਜੂਦ ਹੋਣਗੇ ਤਾਂ ਹੀ ਜਿਹੜਾ ਆਪਣਾ ਸਰੀਰ ਹੈ ਉਹ ਇੱਕ ਵਧੀਆ ਅਤੇ ਸੁਡੋਲ ਸਰੀਰ ਬਣਿਆ ਰਹੇਗਾ ਨਹੀਂ ਤਾਂ ਇਹ ਜਿਹੜਾ ਆਪਣਾ ਖ਼ੁਰਾਕ ਤੋਂ ਬਿਨਾਂ ਆਪਣਾ ਸਰੀਰ ਹੈ ਬਿਲਕੁਲ ਕੋਈ ਕੰਮ ਦਾ ਨਹੀਂ